ਵਿਸ਼ਵ ਦੇ ਕੋਨੇ ਕੋਨੇ ਵਿੱਚ ਫੈਲੇ ਹੋਏ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ਗੁਰੂ ਸਾਹਿਬਨ ਅਤੇ ਪ ਪੀਰਾਂ ਫਕੀਰਾਂ ਦੀ ਸਾਧਨਾ ਵਿੱਚੋਂ ਪੈਦਾ ਅਤੇ ਪ੍ਰਫੁੱਲਿਤ ਹੋਈ ਪੰਜਾਬੀ ਬੋਲੀ ਪੰਜਾਬੀਆਂ ਦੇ ਕੇਵਲ ਮਾਨ ਹੀ ਅੰਗ ਨਹੀਂ ਹੈ ਬਲਕੀ ਪੰਜਾਬੀਆਂ ਦੇ ਸਮੁੱਚੀ ਵਿਰਾਸਤ ਦੇ ਅਧਾਰ ਸਰੋਤ ਵਜੋਂ ਇਸ ਨੂੰ ਸਮਝਿਆ ਅਤੇ ਸਮਝਾਇਆ ਜਾਂਦਾ ਹੈ ਪੰਜਾਬੀ ਭਾਈਚਾਰੇ ਨੂੰ ਇੱਕ ਸੂਤਰ ਵਿੱਚ ਬੰਨਣ ਅਤੇ ਪੰਜਾਬੀ ਦੀਆਂ ਸਮਾਜਿਕ ਅਤੇ ਸਭਿਆਚਾਰਕ ਕਦਰ ਕੀਮਤਾਂ ਨੂੰ ਉਜਾਗਰ ਕਰਨ ਲਈ ਇਸ ਦਾ ਵਿਸ਼ੇਸ਼ ਮਹੱਤਵ ਹੈ ਬੋਲੀ ਨੂੰ ਕਿਸੇ ਨਾ ਕਿਸੇ ਭਾਸ਼ਾ ਵਿੱਚ ਬਿਆਨ ਕੀਤਾ ਜਾਂਦਾ ਹੈ ਅਤੇ ਜਿਹੜੀ ਭਾਸ਼ਾ ਬੱਚੇ ਦੀ ਮਾਂ ਬੋਲਦੀ ਹੈ ਉਹ ਬੱਚੇ ਦੀ ਮਾਤ ਭਾਸ਼ਾ ਬਣ ਜਾਂਦੀ ਹੈ ਇਸ ਦੇ ਆਸਰੇ ਉਹ ਕਦਰਾਂ ਕੀਮਤਾਂ ਨੂੰ ਜੀਵਨ ਵਿੱਚ ਧਾਰਨ ਕਰਦਾ ਹੋਇਆ ਨਿਰੰਤਰ ਅੱਗੇ ਵਧਣ ਲਈ ਯਤਨਸ਼ੀਲ ਰਹਿੰਦਾ ਹੈ ਇਸ ਦ੍ਰਿਸ਼ਟੀ ਤੋਂ ਭਾਸ਼ਾ ਦਾ ਜੀਵਨ ਵਿੱਚ ਵਿਸ਼ੇਸ਼ ਸਥਾਨ ਹੁੰਦਾ ਹੈ ਜਿਹੜੀ ਭਾਸ਼ਾ ਆਮ ਲੋਕਾਂ ਦੇ ਜੀਵਨ ਬ ਹਿੱਸਾ ਬਣਦੀ ਹੈ ਉਹ ਭਾਸ਼ਾ ਮਨੁੱਖ ਨੂੰ ਚੰਗੀ ਲੱਗਦੀ ਹੈ ਭਾਸ਼ਾ ਕੇਵਲ ਮਨੁੱਖੀ ਜ਼ਜ਼ਬਿਆਂ ਅਤੇ ਸੰਦੇਵਨਾਂ ਦਾ ਪ੍ਰਗਟਾਵਾ ਹੀ ਨਹੀਂ ਸਗੋਂ ਇਹ ਸਮਾਜ ਵਿੱਚ ਭਾਈਚਾਰਾ ਸਥਾਪਿਤ ਕਰਨ ਲਈ ਵਿੱਚ ਵੀ ਮਹੱਤਵਪੂਰਨ ਨਿਭ ਭੂਮਿਕਾ ਨਿਭਾਉਂਦੀ ਹੈ ਮਨੁੱਖ ਆਪਣੇ ਭਾਵਨਾਵਾਂ ਨੂੰ ਪ੍ਰਗਟਾਵਾਂ ਜਿੰਨਾ ਵਧੀਆ ਢੰਗ ਨਾਲ ਆਪਣੀ ਮਾਂ ਬੋਲੀ ਵਿੱਚ ਕਰ ਸਕਦਾ ਹੈ ਉਤਨਾ ਬੋਲੀ ਪ੍ਰਤੀ ਸੰਵੇਦਨਸ਼ੀਲ ਅਤੇ ਗੰਭੀਰ ਹੋਣ ਦੀ ਗੰਭੀਰ ਹੋਣ ਦੀ ਭਾਸ਼ਾਵਾਂ ਪ੍ਰਤੀ ਮਜਬੂਰੀ ਅਤੇ ਦਿਖਾਵੇ ਬਸ ਪ੍ਰੇਮ ਪੈਦਾ ਕਰਨ ਲਈ ਨਿਖੇਦੀ ਕਰਦੇ ਹੋਏ ਬਚਨ ਕਰਦੇ ਹਨ ਖਤਰੀਆਂ ਦਾ ਧਰਮ ਛੱਡਿਆ ਮਲੇਸ਼ ਭਾਖਿਆ ਗਹੀ ਵਪਾਰ ਅਤੇ ਰੁਜ਼ਗਾਰ ਨੇ ਲੋਕਾਂ ਨੂੰ ਦੂਰ ਦੁਹਾਡੇ ਤੋਂ ਖੇਤਰਾਂ ਵਿੱਚ ਜਾਣ ਲਈ ਮਜਬੂਰ ਕੀਤਾ ਹੈ ਵਪਾਰੀ ਉਹ ਸਫਲ ਹੋ ਸਕਦਾ ਹੈ ਜਿਹੜਾ ਸਥਾਨਕ ਭਾਸ਼ਾ ਬੋਲੀ ਅਤੇ ਸੱਭਿਆਚਾਰ ਤੋਂ ਜਾਣੂ ਹੋਵੇ ਵਾਪਰਾ ਦੇ ਆਦਾਨ ਪਦਾਨ ਨਾਲ ਬਹੁਤ ਸਾਰੀਆਂ ਵਿਭਿੰਨ ਭਾਸ਼ਾਵਾਂ ਆਮ ਲੋਕਾਂ ਦੇ ਜੀਵਨ ਦੀਆਂ ਹਿੱਸਾ ਬਣ ਜਾਂਦੀਆਂ ਹਨ ਭਾਸ਼ਾ ਦਾ ਮੰਡੀ ਅਤੇ ਰਾਜ ਨਾਲ ਜੁਨਾ ਇੱਕ ਆਮ ਵਰਤਾਰਾ ਹੈ ਇਸ ਵਿੱਚ ਕੋਈ ਸੰਖਾ ਨਹੀਂ ਹੈ ਜਿਹੜੀ ਭਾਸ਼ਾ ਰੁਜ਼ਗਾਰ ਪੈਦਾ ਕਰਦੀ ਹੈ ਆ ਭਾਰਤ ਵਿੱਚ ਮੁਗਲ ਰਾਜ ਦੀ ਸਥਾਪਨਾ ਇਸ ਇਸਲਾਮ ਤੋਂ ਇਥੋਂ ਦੇ ਲੋਕਾਂ ਨੇ ਗਹਿਰਾ ਵਾ ਪ੍ਰਭਾਵ ਪਾਇਆ ਹੈ ਮੁਸਲਮਾਨ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਪ੍ਰਭਾਵ ਦਾ ਜਿਹੜਾ ਵਰਤਾਰਾ ਆਮ ਲੋਕਾਂ ਵਿੱਚ ਪਿਆ ਹੈ